ਹਾਂਜੀ ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਕੁ ਸੁੰਦਰ ਪਲ ਸ਼ੇਅਰ ਕਰਨਾ ਚਾਹੁੰਦਾ ਹਾਂ ਜੋ ਕਿ ਕਾਫੀ ਖੂਬਸੂਰਤ ਸਨ ਜਿਸ ਦੇ ਵਿੱਚ ਵੀ ਮੈਂ ਮਤਲਬ ਅਲੱਗ ਅਲੱਗ ਜਗ੍ਹਾਵਾਂ 'ਤੇ ਘੁੰਮਣ ਦਾ ਸ਼ੌਕੀਨ ਹਾਂ ਮੈਂ ਤੁਹਾਨੂੰ ਆਪਣੀ ਸਭ ਤੋਂ ਸੁੰਦਰ ਯਾਤਰਾ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਜੋ ਕਿ ਮੈਂ ਆਪਣੀ ਲਾਈਫ ਵਿੱਚ ਸਭ ਤੋਂ ਬੈਸਟ ਮੰਨਦਾ ਹਾਂ ਇਹ ਯਾਤਰਾ ਮੈਂ ਅਜਮੇਰ ਸ਼ਰੀਫ ਦੀ ਕੀਤੀ ਸੀ ਇਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਮੈਂ ਮੇਰਾ ਭਰਾ ਅਤੇ ਮੇਰੇ ਭਰਾ ਦਾ ਦੋਸਤ ਅਸੀਂ ਤਿੰਨਾਂ ਨੇ ਪਲਾਨ ਬਣਾਇਆ ਅਸੀਂ ਕਦੇ ਵੀ ਅਜਮੇਰ ਸ਼ਰੀਫ ਵਿਖੇ ਨਹੀਂ ਆਏ ਸੀ ਪ੍ਰੰਤੂ ਜੋ ਮੇਰੇ ਭਰਾ ਦਾ ਦੋਸਤ ਹੈ ਉਹ ਕਾਫੀ ਵਾਰ ਅਜਮੇਰ ਸ਼ਰੀਫ ਆ ਚੁੱਕਿਆ ਹੈ ਜਿਸ ਕਰਕੇ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਹੀ ਜਾ ਕੇ ਆਈਏ ਇਸ ਜਗ੍ਹਾ 'ਤੇ ਉਸ ਵੱਲੋਂ ਸਾਨੂੰ ਦੱਸਿਆ ਗਿਆ ਕਿ ਅਜਮੇਰ ਸ਼ਰੀਫ ਜਾ ਕੇ ਬਹੁਤ ਹੀ ਸਕੂਨ ਮਿਲਦਾ ਹੈ ਅਤੇ ਇੱਥੇ ਕਾਫੀ ਦੁਆਵਾਂ ਵੀ ਪੂਰੀਆਂ ਹੁੰਦੀਆਂ ਹਨ ਉਸ ਤੋਂ ਬਾਅਦ ਅਸੀਂ ਤਿੰਨਾਂ ਨੇ ਟਰੇਨ ਦੀ ਟਿਕਟ ਬੁੱਕ ਕਰਵਾਈ ਅਸੀਂ ਪਹਿਲਾਂ ਬੱਸ ਤੋਂ ਬਠਿੰਡਾ ਗਏ ਬਠਿੰਡੇ ਤੋਂ ਅਸੀਂ ਟ੍ਰੇਨ ਦੀ ਟਿਕਟ ਕਰਵਾਈ ਸਾਡੀ ਟਰੇਨ ਦਾ ਸਮਾਂ ਰਾਤ ਦਾ ਸੀ ਅ ਅਸੀਂ ਉੱਥੇ ਦੋ ਘੰਟੇ ਬੈਠੇ ਰਹੇ ਅਤੇ ਟਰੇਨ ਦੀ ਵੇਟ ਕਰਦੇ ਰਹੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਟ੍ਰੇਨ ਆ ਗਈ ਅਤੇ ਅਸੀਂ ਆਪਣੇ ਡੱਬਿਆਂ ਵਿੱਚ ਚੜ੍ਹ ਗਏ ਟਰੇਨ ਦੇ ਡੱਬਿਆਂ ਦੇ ਵਿੱਚ ਕਾਫੀ ਰਸ਼ ਸੀ ਜਿਸ ਕਰਕੇ ਸਾਨੂੰ ਖੜ੍ਹ ਕੇ ਹੀ ਕੁਝ ਰਸਤਾ ਸਾਨੂੰ ਖੜ੍ਹ ਕੇ ਹੀ ਤੈਅ ਕਰਨਾ ਪਿਆ ਉਸ ਤੋਂ ਬਾਅਦ ਅਸੀਂ ਅਜਮੇਰ ਸ਼ਰੀਫ ਅਸੀਂ ਸੌਂ ਗਏ ਅਤੇ ਜਦੋਂ ਅਸੀਂ ਉੱਠੇ ਤਾਂ ਅਸੀਂ ਅਜਮੇਰ ਸ਼ਰੀਫ ਦੇ ਲਾਗੇ ਪਿੰਡ ਦੇ ਲਵੇ ਪਹੁੰਚ ਗਏ ਉਸ ਤੋਂ ਬਾਅਦ ਅਸੀਂ ਟਰੇਨ ਤੋਂ ਉਤਰ ਕੇ ਬੱਸ ਦੀ ਖੋਜ ਕੀਤੀ ਪਰੰਤੂ ਸਾਨੂੰ ਕੋਈ ਵੀ ਬੱਸ ਨਾ ਮਿਲੀ ਉਸ ਤੋਂ ਬਾਅਦ ਅਸੀਂ ਆਟੋ ਦੇਖਿਆ ਆਟੋ ਵਾਲੇ ਨੂੰ ਪੈਸੇ ਦਿੱਤੇ ਅਤੇ ਅਸੀਂ ਅਜਮੇਰ ਸ਼ਰੀਫ ਤਕਰੀਬਨ ਘੰਟੇ ਦੇ ਵਿੱਚ ਪਹੁੰਚ ਗਏ ਉਸ ਤੋਂ ਬਾਅਦ ਅਸੀਂ ਉੱਥੇ ਮਸ਼ਹੂਰ ਖਵਾਜਾ ਪੀਰ ਜੀ ਦੀ ਦਰ ਦਰਗਾਹ ਉੱਪਰ ਗਏ ਅਤੇ ਉੱਥੇ ਦਰਸ਼ਨ ਕੀਤੇ ਉਹਨਾਂ ਦੇ

ਮਿਠਾਈਆਂ ਖਰੀਦੀਆਂ ਕੱਪੜੇ ਲਏ ਉਸ ਤੋਂ ਬਾਅਦ ਅਸੀਂ ਇੱਕੋ ਰੈਸਟੋਰੈਂਟ ਵਿੱਚ ਬਹਿ ਕੇ ਆਲੂਆਂ ਦੇ ਪਰੌਂਠੇ ਹੀ ਖਾਧੇ ਅਤੇ ਉੱਥੋਂ ਦਾ ਸਵਾਦਿਸ਼ਟ ਲੱਸੀ ਵਗੈਰਾ ਪੀਤੀ ਉਸ ਤੋਂ ਬਾਅਦ ਅਸੀਂ ਆਪਣੇ ਰੂਮ ਦੇ ਵਿੱਚ ਜਾ ਕੇ ਪੈ ਗਏ ਫਿਰ ਅਸੀਂ ਅਜਮੇਰ ਸ਼ਰੀਫ ਤੋਂ ਉੱਥੇ ਅਸੀਂ ਦੋ ਦਿਨ ਬਿਤਾਏ ਅਤੇ ਉਸ ਤੋਂ ਬਾਅਦ ਅਸੀਂ ਵਾਪਸੀ ਲਈ ਰਵਾਨਾ ਹੋ ਗਏ ਇਹ ਸਫਰ ਇੰਨਾਂ ਕੁ ਵਧੀਆ ਸੀ ਕਿ ਹਮੇਸ਼ਾ ਸਾਡੇ ਲਈ ਯਾਦਗਾਰ ਰਹੇਗਾ ਅਤੇ ਤੁਹਾਨੂੰ ਵੀ ਇਸ ਲਈ ਜਾਣਾ ਚਾਹੀਦਾ ਹੈ